ਸਾਡੇ ਪਿੰਡ ਜਿਹੜਾ ਸਿੰਚਾਈ ਦਾ ਸਾਧਨ ਹੈ ਉਹ ਸਬੰਸੀਬਲ ਮੋਟਰਾਂ ਤੋਂ ਹੁੰਦਾ ਹੈ ਸਾਡੇ ਜਿਹੜੀ ਜ਼ਮੀਨ ਹੈਗੀ ਉਹ ਡਾਕਰ ਜ਼ਮੀਨ ਹੈ ਜਿਸ ਨੂੰ ਭਾਰੀ ਜ਼ਮੀਨ ਵੀ ਕਹਿ ਦਿੰਦੇ ਹਨ ਇਸ ਵਿੱਚ ਸਭ ਤੋਂ ਖਾਸੀਅਤ ਇਹ ਗੱਲ ਹੈ ਵੀ ਇਹ ਪਾਣੀ ਦੀ ਮਾਰ ਵੀ ਝੱਲਦੀ ਹੈ ਅਤੇ ਸੋਕਾ ਵੀ ਝੱਲਦੀ ਹੈ ਇਸ ਵਿੱਚ ਫਸਲਾਂ ਉਹ ਕਣਕ ਜੀਰੀ ਗੰਨਾ ਮੁੱਖ ਤੌਰ 'ਤੇ ਫਸਲਾਂ ਹੁੰਦੀਆਂ ਹਨ ਜਿਵੇਂ ਮੱਝਾਂ ਦੇ ਚਾਰੇ ਲਈ ਸਰਦੀਆਂ ਦੇ ਵਿੱਚ ਬਰਸੀਮ ਗਰਮੀਆਂ ਦੇ ਵਿੱਚ ਹਰੇ ਚਾਰੇ ਲਈ ਚਰ੍ਹੀ ਟਾਂਡੀ ਆਦਿ ਫਸਲਾਂ ਹੁੰਦੀਆਂ ਹਨ ਅਤੇ ਜਿਹੜੇ ਸਾਡੇ ਪਿੰਡ ਦਾ ਮਾਹੌਲ ਦੀ ਗੱਲ ਕਰੀਏ ਵੀ ਸਾਡੇ ਜਿਹੜੇ ਪਿੰਡ ਦੇ ਬਾਹਰ ਜਿਵੇਂ ਕੁਦਰਤੀ ਆਫਤਾਂ ਆਉਂਦੀਆਂ ਹਨ ਸਾਡੇ ਪਿੰਡ ਵਿੱਚੋਂ ਬਾਹਰ ਦਾ ਪਾਣੀ ਨਹੀ ਹੁੰਦਾ ਸੀ ਕੇਵਲ ਮੀਂਹ ਦਾ ਪਾਣੀ ਹੀ ਆਉਂਦਾ ਹੈ ਜਿਸ ਨਾਲ ਫਸਲਾਂ ਨੂੰ ਵੀ ਬਚਾਅ ਰਹਿੰਦਾ ਹੈ ਅਤੇ ਪਿੰਡ ਨੂੰ ਵੀ ਬਚਾਅ ਰਹਿੰਦਾ ਹੈ